ਹੈਲੋ ਸਤਿ ਸ਼੍ਰੀ ਅਕਾਲ ਕੁਕੂ ਬਾਈ ਜੀ ਮੈਂ ਮੈਨੂੰ ਤੁਹਾਡਾ ਨੰਬਰ ਨਾ ਓਲਾ ਵਾਲਿਆਂ ਨੇ ਦਿੱਤਾ ਸੀਗਾ ਮੈਂ ਇੱਕ ਕੈਬ ਬੁੱਕ ਕੀਤੀ ਸੀਗੀ ਉਹਨਾਂ ਨੇ ਤੁਹਾਡਾ ਨੰਬਰ ਭੇਜਿਆ ਹੈਗਾ ਅਤੇ ਮੈਂ ਮੁਲਤਾਨੀਆ ਪੁੱਲ ਵਾਲੀ ਸਾਈਡ ਤੋਂ ਜਾਣਾ ਸੀਗਾ ਵੈਸੇ ਤਾਂ ਠੰਡੀ ਸੜਕ ਵੱਲ ਪਰ ਉਧਰ ਹੁਣ ਉਹ ਪੁੱਲ ਬਣਨ ਕਰਕੇ ਸਾਰਾ ਉਹ ਰਸਤਾ ਬਲੋਕ ਹੈਗਾ ਅਤੇ ਮੈਂ ਗੁਰਦੁਆਰਾ ਸਾਹਿਬ ਕੋਲ ਖੜ੍ਹੀ ਹਾਂ ਪੁੱਲ ਵਾਲੇ ਕੋਲ ਤੁਸੀਂ ਕਿੰਨੀ ਜਲਦੀ ਮੇਰੇ ਕੋਲ ਪਹੁੰਚ ਸਕਦੇ ਹੈਗੇ ਹੋ ਕਿਉਂਕਿ ਹੁਣ ਆਪਾਂ ਨੂੰ ਘੁੰਮ ਕੇ ਉੱਪਰ ਦੀ ਸ਼ਹਿਰ ਵਿੱਚ ਦੀ ਜਾਣਾ ਪੈਣਾ ਅਤੇ ਲਾਈਟਾਂ ਵੀ ਕਾਫ਼ੀ ਪੈ ਜਾਣਗੀਆਂ ਇਸ ਕਰਕੇ ਤੁਸੀਂ ਦੇਖੋ ਪਰ ਮੇਰਾ ਉੱਥੇ ਪਹੁੰਚਣਾ ਬਹੁਤ ਜ਼ਰੂਰੀ ਹੈਗਾ ਤੁਸੀਂ ਜਲਦੀ ਚ ਜਲਦੀ ਉੱਥੇ ਪਹੁੰਚ ਕੇ ਉੱਪਰ ਦੀ ਜਾ ਕੇ ਆਪਾਂ ਨੂੰ ਸ਼ਹਿਰ ਵਿੱਚੋਂ ਦੀ ਉਸ ਪੁਆਇੰਟ 'ਤੇ ਮੇਰਾ ਪਹੁੰਚਣਾ ਜ਼ਰੂਰੀ ਹੈਗਾ ਅਤੇ ਹੁਣ ਤੁਸੀਂ ਮੈਨੂੰ ਦੱਸੋ ਤੁਸੀਂ ਕਿੰਨੇ ਸਮੇਂ ਤੱਕ ਮੇਰੇ ਕੋਲ ਪਹੁੰਚ ਜਾਓਗੇ